ਮੈਨੂੰ ਯੋਗਾ ਦਾ ਬੜਾ ਸ਼ੌਂਕ ਹੈ ਤਾਂ ਮੈਂ ਪਿਛਲੇ ਕਈ ਸਾਲਾਂ ਤੋਂ ਯੋਗਾ ਕਰ ਰਿਹਾ ਹਾਂ ਪਹਿਲਾਂ ਮੈਂ ਆਪਣੇ ਘਰ ਵਿੱਚ ਯੋਗਾ ਕਰਦਾ ਸੀ ਤੇ ਮੈਂ ਸੰਤੁਸ਼ਟ ਸੀ ਕਿ ਮੈਂ ਠੀਕ ਕਰ ਰਿਹਾ ਸਾਰਾ ਕੁਝ ਠੀਕ ਚੱਲ ਰਿਹਾ ਚਲੋ ਕੁਛ ਨਾ ਕੁਛ ਫਾਇਦਾ ਹੁੰਦਾ ਯੋਗਾ ਦਾ ਲੇਕਿਨ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਯੋਗਾ ਦੀ ਕਲਾਸ ਲਗਾ ਕੇ ਆਓ ਉਥੋਂ ਤੁਹਾਨੂੰ ਅੱਛੀ ਤਰ੍ਹਾਂ ਸਿਖਾਇਆ ਜਾਏਗਾ ਮੈਂ ਯੋਗਾ ਦੀ ਕਲਾਸ ਲਗਾਣ ਗਿਆ ਤਾਂ ਫਿਰ ਮੈਨੂੰ ਪਤਾ ਚੱਲਿਆ ਕਿ ਮੈਂ ਬਹੁਤ ਸਾਰੇ ਆਸਨ ਜਿਹੜੇ ਸੀ ਗਲਤ ਤਰੀਕੇ ਨਾਲ ਕਰ ਰਿਹਾ ਸੀਗਾ ਘੱਟ ਟਾਈਮ ਲਈ ਕਰ ਰਿਹਾ ਸੀ ਜਾਂ ਜਿੰਨਾ ਮੈਨੂੰ ਬੈਂਡ ਹੋਣਾ ਚਾਹੀਦਾ ਉਹਨਾਂ ਬੈਡ ਨਹੀਂ ਹੋ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਯੋਗਾ ਠੀਕ ਹੈ ਸਿਹਤ ਲਈ ਅੱਛਾ ਪਰ ਕਲਾਸ ਦੇ ਵਿੱਚ ਜਾ ਕੇ ਚੰਗੀ ਤਰ੍ਹਾਂ ਸਿੱਖ ਕੇ ਫੇਰ ਘਰੇ ਕਰਨਾ ਚਾਹੀਦਾ ਇਹ ਨਹੀਂ ਕਿ ਘਰੇ ਕਰਨਾ ਸ਼ੁਰੂ ਕਰ ਦਿੱਤਾ ਸਾਨੂੰ ਪਤਾ ਹੀ ਨਹੀਂ ਵੀ ਸਹੀ ਹੋ ਰਿਹਾ ਕਿ ਗਲਤ ਹੋ ਰਿਹਾ ਤਾ ਕਲਾਸ ਜਿਹੜੀ ਹੈ ਉਹ ਬਹੁਤ ਜਰੂਰੀ ਹੈ ਉੱਥੇ ਅਭਿਆਸ ਕਰਨਾ ਜਰੂਰੀ ਹੈ ਉੱਥੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਜੋ ਮੈਂ ਘਰ ਕਰ ਰਿਹਾ ਸੀ ਉਹ ਠੀਕ ਨਹੀਂ ਸੀ ਤਾਂ ਜੇ ਪੂਰਾ ਬੈਨੀਫਿਟ ਲੈਣਾ ਤਾਂ ਸਾਰਿਆਂ ਨੂੰ ਪਹਿਲਾਂ ਯੋਗਾ ਦਾ ਕਲਾਸ ਦੇ ਵਿੱਚ ਜਾ ਕੇ ਅਭਿਆਸ ਕਰਨਾ ਚਾਹੀਦਾ ਮੈਨੂੰ ਕਲਾਸ ਦੇ ਵਿੱਚ ਜਾ ਕੇ ਅਭਿਆਸ ਕਰਨ ਨਾਲ ਬੜਾ ਬੈਨੀਫਿਟ ਹੋਇਆ ਬੜਾ ਫਾਇਦਾ ਹੋਇਆ ਹੁਣ ਮੈਂ ਘਰ ਚ ਯੋਗਾ ਕਰਦਾ ਹੁੰਦਾ ਮੈਨੂੰ ਜਿਆਦਾ ਪਤਾ ਮਹਿਸੂਸ ਹੁੰਦਾ ਕਿ ਹਾਂ ਮੈਨੂੰ ਕੋਈ ਨਾ ਕੋਈ ਐਕਟੀਵਿਟੀ ਕੀਤੀ ਹੈ ਤੇ ਮੈਨੂੰ ਉਸ ਦਾ ਡੈਫੀਨੇਟਲੀ ਜਿਹੜਾ ਜਰੂਰ ਫਾਇਦਾ ਮਿਲੇਗਾ